ਖਬਰਾਂ ਸੁਣਦੇ ਹਾਂ ਅਸੀਂ ਇੱਕ ਤਾਂ ਟੀ ਵੀ ਨਾਲ ਵੀ ਦੇਖਦੇ ਹਾਂ ਅਤੇ ਦੂਜਾ ਅਖ਼ਬਾਰ ਰਾਹੀਂ ਵੀ ਹਰ ਘਰ 'ਚ ਅਖ਼ਬਾਰ ਆਉਂਦਾ ਹੈ ਉਹਦੇ ਨਾਲ ਵੀ ਅਸੀਂ ਜਾਣੂ ਹੁੰਦੇ ਖਬਰਾਂ ਤੋਂ ਉਸ ਤੋਂ ਬਾਅਦ ਟੀ ਵੀ ਦੇ ਵਿੱਚ ਵੀ ਆ ਰਹੀਆਂ ਨੇ ਔਨਲੈਨ ਵੀ ਮੀਡੀਆ ਦੇ ਥਰੂ ਵੀ ਅਸੀਂ ਖਬਰਾਂ ਦੇਖਦੇ ਹਾਂ ਵਾਈਵਸਾਈਡ 'ਤੇ ਵੀ ਜਾ ਕੇ ਨਿਊਜ਼ ਦੇਖ ਸਕਦੇ ਹਾਂ